ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਹਾਂਜੀ ਅੱਛਾ ਜੀ ਫੀਸ ਬੇਟੇ ਸਾਡੇ ਕੋਲ ਇਸ ਤਰ੍ਹਾਂ ਆ ਅਲੱਗ ਅਲੱਗ ਜਿੱਦਾਂ ਪਲੈਨ ਹੁੰਦੇ ਆ ਅਤੇ ਇੱਕ ਤਾਂ ਵਨ ਟਾਈਮ ਵੀ ਸਾਡਾ ਚੱਲਦਾ ਜਿੱਦਾਂ ਤਿੰਨ ਮਹੀਨੇ ਦਾ ਤੁਸੀਂ ਲੈਂਦੇ ਆ ਅਤੇ ਉਹਦਾ ਪੈਕ ਹੈਗਾ ਆਪਣਾ ਪੰਦਰਾਂ ਹਜ਼ਾਰ ਦਾ ਅਤੇ ਬਾਕੀ ਜੇ ਤੁਸੀਂ ਤੁਹਾਨੂੰ ਲੱਗਦਾ ਵੀ ਤੁਸੀਂ ਪੜ੍ਹਨ 'ਚ ਅੱਛੇ ਆ ਤਿਆਰੀ ਦੇ ਹਿਸਾਬ ਨਾਲ ਤਾਂ ਤੁਸੀਂ ਮਹੀਨਾ ਮਹੀਨੇ ਮਹੀਨਾ ਮਹੀਨੇ ਦੇ ਮਹੀਨੇ ਵੀ ਸਕਦੇ ਆ ਫੀਸ ਜੀ ਕਲਾਸ ਬੱਚੇ ਦੋ ਘੰਟੇ ਦੀ ਹੁੰਦੀ ਹੈ ਅਤੇ ਬਾਕੀ ਜੇ ਸਟੂਡੈਂਟ ਥੋੜ੍ਹਾ ਚਾਹੇ ਥੋੜ੍ਹਾ ਉਹਨੂੰ ਕਮਜ਼ੋਰ ਲੱਗ ਰਿਹਾ ਜਾਂ ਵੀਕ ਲੱਗ ਰਿਹਾ ਸਟੱਡੀ 'ਚ ਤਾਂ ਉਹਨੂੰ ਅਸੀਂ ਆਪਾਂ ਘੰਟਾ ਕੁ ਐਕਸਟਰਾ ਵੀ ਲਗਵਾ ਦਈ ਦਾ ਹਾਂਜੀ ਘੱਟ ਬੇਟੇ ਜਿੱਦਾਂ ਆਪਾਂ ਅਗਰ ਤੁਸੀਂ ਥੋੜ੍ਹਾ ਇਟੈਲੀਜੈਂਟ ਹੋ ਤੁਸੀਂ ਕਰ ਲਉਗੇ ਜਲਦੀ ਪੜ੍ਹ ਲਉਗੇ ਜਿੱਦਾਂ ਥੋੜ੍ਹੀ ਤੁਹਾਡੀ ਤਿਆਰੀ 'ਤੇ ਡਿਪੈਂਡ ਕਰੇਗਾ ਫਿਰ ਜੇ ਬੰਦਾ ਬੱਚਾ ਲੋੜਵੰਦ ਆ ਅਸੀਂ ਦੇਖ ਕੇ ਉਹਦੇ ਅਕੋਰਡਿੰਗ ਉਹਨੂੰ ਥੋੜ੍ਹਾ ਡਿਸਕਾਊਂਟ ਵੀ ਦੇ ਦਈ ਦਾ ਰਿਲੈਕਸੇਸ਼ਨ ਦੇ ਦਈ ਦੀ ਫੀਸ 'ਚ ਕਲਾਸ ਤੁਸੀਂ ਕਿਹੜੀ ਲੈਣੀ ਮੌਰਨਿੰਗ ਵਾਲਾ ਬੈਚ ਲੈਣਾ ਜਾਂ ਈਵਨਿੰਗ ਵਾਲਾ ਮੋਰਨਿੰਗ ਜਿੱਦਾਂ ਮਤਲਬ ਨੌ ਵਜੇ ਹੁੰਦਾ ਆ ਪਹਿਲਾ ਸੈਸ਼ਨ ਅਤੇ ਸ਼ਾਮ ਨੂੰ ਚਾਰ ਵਜੇ ਹੁੰਦਾ ਹੈ ਹਾਂ ਬੱਚੇ ਤੁਸੀਂ ਸਾਡੇ ਔਫਿਸ ਵਿਜਿਟ ਕਰ ਲਉ ਅਤੇ ਉੱਥੇ ਤੁਹਾਨੂੰ ਸਾਰਾ ਐਕਸਪਲੇਨ ਕਰ ਦੇਵਾਂਗੇ ਓਕੇ ਜੀ ਓਕੇ